ਮੈਂ ਪ੍ਰੇਮ ਸਿੰਘ ਵਾਸੀ ਮਿਰਜਾਪੁਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੱਧ ਪੁਰਸ਼ ਸਾਡੀਆਂ ਫਸਲਾਂ ਦਾ ਉਪਰਾਂਤ ਵੇਚਣ ਵਿੱਚ ਸਾਡੀ ਸ਼ੋਸ਼ਣ ਕਰਦੇ ਹਨ ਜਦੋਂ ਵੀ ਸਾਨੂੰ ਬੀਜ ਖਾਦ ਆਦਿ ਚਾਹੀਦੇ ਹੁੰਦੇ ਹਨ ਤਾਂ ਸਾਨੂੰ ਉਪਲਬਧ ਕਰਵਾਉਂਦੇ ਹਨ ਉਸ ਤੋਂ ਬਾਅਦ ਜਦੋਂ ਸਾਡਾ ਫਸਲ ਬੀਜਣ ਤੋਂ ਬਾਅਦ ਜਦੋਂ ਸਾਡੀ ਫਸਲ ਤਿਆਰ ਹੋ ਜਾਂਦੀ ਹੈ ਤਾਂ ਫਿਰ ਉਹ ਸਾਨੂੰ ਸਾਨੂੰ ਉਹ ਸਾਡੇ ਕੋਲ ਜ਼ਿਆਦਾ ਗੇੜੇ ਮਾਰਦੇ ਹਨ ਕਿ ਸਾਡੇ ਕੋਲ ਫਸਲ ਵੇਚਣੀ ਹੈ ਸਾਡੇ ਕੋਲੋਂ ਫਸਲ ਜੋ ਆ ਉਹਨਾਂ ਨੇ ਸਸਤੇ ਦਾਮ 'ਤੇ ਲੈਣੀ ਹੈ ਸਸਤੀ ਫਸਲ ਲੈ ਕੇ ਅੱਗੇ ਉਹਨਾਂ ਨੇ ਮਹਿੰਗੀ ਕਰਕੇ ਵੇਚਣੀ ਹੈ ਕਿਉਂਕਿ ਉਸ ਵੇਲੇ ਜਿਸ ਵੇਲੇ ਤਾਂ ਅਸੀਂ ਬੀਜ ਜਾਂ ਖਾਦ ਜਾਂ ਦਵਾਈਆਂ ਖਰੀਦਦੇ ਹਾਂ ਤਾਂ ਸਾਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ ਤਾਂ ਸਾਡੇ ਕੋਲ ਪੈਸੇ ਨਾ ਹੋਣ ਕਾਰਨ ਸਾਨੂੰ ਇਹਨਾਂ ਕੋਲੋਂ ਉਧਾਰ ਖਰੀਦਣੇ ਪੈਂਦਾ ਹੈ ਜੇ ਉਧਾਰ ਅਸੀਂ ਨਾ ਦਈਏ ਤਾਂ ਉਹ ਸਾਡੀਆਂ ਫਸਲਾਂ ਤਾਂ ਨਾ ਖਰੀਦਣਗੇ ਅਤੇ ਜੇ ਅਸੀਂ ਉਹਨਾਂ ਕੋਲੋਂ ਉਧਾਰ ਲੈ ਕੇ ਫਸਲਾਂ ਬੀਜਦੇ ਹਾਂ ਤਾਂ ਫਿਰ ਸਾਨੂੰ ਉਹਨਾਂ ਨੂੰ ਹੀ ਫਸਲ ਦੇਣੀ ਪੈਂਦੀ ਹੈ ਫਸਲ ਦੇਣ ਦੇ ਨਾਲ ਸਾਨੂੰ ਉਹ ਘੱਟ ਕੀਮਤ 'ਤੇ ਸਾਡੀ ਉਹ ਫਸਲ ਖਰੀਦ ਕੇ ਅਤੇ ਆਪਣੀ ਉਹ ਵੱਧ ਕੀਮਤ 'ਤੇ ਵੇਚਦੇ ਹਨ ਸਾਡੀ ਮਦਦ ਜਾਂ ਸ਼ੋਸ਼ਣ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਹੀ ਯੋਗਦਾਨ ਹੁੰਦਾ ਹੈ ਕਿਉਂਕਿ ਸਾਡਾ ਸਾਡੀ ਜੋ ਅਸੀਂ ਫਸਲ ਬੀਜੀ ਹੈ ਸਾਡੀ ਉਹਦੀ ਪ੍ਰੋਪਰ ਮੁੱਲ ਨਹੀਂ ਮਿਲਦਾ ਕਿਉਂਕਿ ਅਸੀਂ ਆਪਣੇ ਦੁਕਾਨਦਾਰ ਜਾਂ ਪਹਿਲੇ ਜਿਨ੍ਹਾਂ ਕੋਲੋਂ ਅਸੀਂ ਉਧਾਰ ਦਵਾਈ ਬੀਜ ਆਦਿ ਲਿਤੇ ਹੁੰਦੇ ਹਨ ਉਹਨਾਂ ਦਾ ਵੀ ਉਧਾਰ ਮੁਕਾਉਣਾ ਪੈਂਦਾ ਹੈ ਇਸ ਲਈ ਮੈਂ ਇਹਨਾਂ ਦੁਕਾਨਦਾਰਾਂ ਨੂੰ ਕਹਿੰਦਾ ਹਾਂ ਕਿ ਸਾਨੂੰ ਸਾਡਾ ਸ਼ੋਸ਼ਣ ਨਾ ਕਰਦੇ ਹੋਏ ਸਾਨੂੰ ਸਾਡੀ ਮਦਦ ਕੀਤੀ ਜਾਵੇ ਧੰਨਵਾਦ ਜੀ